ਅਸੀਂ ਨੈਣਾਂ ਦੇਵੀ ਅਸੀਂ ਨੈਣਾਂ ਦੇਵੀ ਵਿੱਚ ਅਸੀਂ ਨੈਣਾਂ ਨੈਣਾਂ ਦੇਵੀ ਵਿੱਚ ਇੱਕ ਦਿਨ ਦੀ ਯਾਤਰਾ ਕੀਤੀ ਇਹ ਯਾਤਰਾ ਬਹੁਤ ਔਖੀ ਹੈ ਅਸੀਂ ਯਾਤਰਾ ਗੱਡੀ ਵਿੱਚ ਗਏ ਗੱਡੀ ਤੋਂ ਬਾਅਦ ਅਸੀਂ ਗੱਡੀ ਤੋਂ ਬਾਅਦ ਅਸੀਂ ਨੈਣਾਂ ਦੇਵੀ ਪਹੁੰਚੇ ਨੈਣਾਂ ਦੇਵੀ ਤੋਂ ਬਾਅਦ ਕੌਲ ਕੌਲਾਂ ਵਾਲੇ ਟੋਭੇ ਤੋਂ ਅਸੀਂ ਯਾਤਰਾ ਪੈਦਲ ਕੀਤੀ ਪੌੜੀਆਂ ਚੜ੍ਹ ਕੇ ਸਾਰੀਆਂ ਪੌੜੀਆਂ ਚੜ੍ਹ ਕੇ ਪੈਦਲ ਗਏ ਪੈਦਲ ਜਾਂਦੇ ਜਾਂਦੇ ਸਾਡੇ ਸਾਹ ਅਤੇ ਸਾਹ ਫੁੱਲਦੇ ਸੀ ਅਤੇ ਲੱਤਾਂ ਬਹੁਤ ਦੁਖਦੀਆਂ ਸੀ ਰਸਤੇ ਵਿੱਚ ਲੱਤਾਂ ਮਾਲਸ਼ ਕਰਨ ਵਾਲੇ ਬੈਠੇ ਸੀ ਅਸੀਂ ਉਨ੍ਹਾਂ ਤੋਂ ਆਪਣੀਆਂ ਲੱਤਾਂ ਮਾਲਸ਼ ਕਰਵਾਈਆਂ ਅਤੇ ਅਗਾਹਾਂ ਅੱਗੇ ਵੱਲ ਨੂੰ ਗਏ ਅੱਗੇ ਵੱਲ ਨੂੰ ਗਏ ਅਤੇ ਰਸਤੇ ਵਿੱਚ ਅਸੀਂ ਥੋੜ੍ਹਾ ਥੋੜ੍ਹਾ ਸਾਹ ਵੀ ਲੈਂਦੇ ਗਏ ਇਸ ਤਰ੍ਹਾਂ ਅਸੀਂ ਨੈਣਾਂ ਦੇਵੀ ਦੇ ਮੰਦਰ ਪਹੁੰਚ ਗਏ ਉੱਥੇ ਅਸੀਂ ਸ਼ਾਮ ਨੂੰ ਮੱਥਾ ਟੇਕ ਕੇ ਵਾਪਸ ਆਏ ਵਾਪਸ ਆ ਕੇ ਉਸੇ ਤਰ੍ਹਾਂ ਅਸੀਂ ਫੇਰ ਪੌੜੀਆਂ ਨੀਚੇ ਇੱਕ ਪੈਦਲ ਨੀਚੇ ਉੱਤਰ ਕੇ ਆਏ ਤੋਂ ਬਾਅਦ ਅਸੀਂ ਗੱਡੀ ਦੇ ਵਿੱਚ ਵਾਪਸ ਆਪਣੇ ਵਾਪਸ ਆਪਣੇ ਲੁਧਿਆਣੇ ਆਏ ਇਹਦੇ ਇਹ ਯਾਤਰਾ ਬਹੁਤ ਔਖੀ ਹੈ ਇਸ ਯਾਤਰਾ ਵਿੱਚ ਬਜ਼ੁਰਗ ਬਜ਼ੁਰਗ ਹੈ ਨਾ ਵੱਡੀ ਉਮਰ ਦੇ ਜਾਂ ਜਿਨ੍ਹਾਂ ਦੀ ਸਿਹਤ ਨਹੀਂ ਠੀਕ ਉਹ ਨਾ ਜਾਣ ਅਤੇ ਬੱਚੇ ਛੋਟੇ ਬੱਚਿਆਂ ਨੂੰ ਜਾਣਾ ਵੀ ਬਹੁਤ ਔਖਾ ਹੈ ਅਤੇ ਛੋ ਕਿਉਂਕਿ ਆਪਣਾ ਆਪ ਈ ਮਸਾਂ ਸਾਂਭ ਹੁੰਦਾ ਹੈ ਅਤੇ ਬੱਚਿਆਂ ਦੀ ਪ ਧਿਆਨ ਰੱਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਬੱ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਥੋੜ੍ਹਾ ਸਾਵਧਾਨ ਰਹਿਣਾ ਚਾਹੀਦਾ ਅਤੇ ਛੋਟੇ ਬੱਚਿਆਂ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ ਚਾਹੀਦਾ ਇਹ ਯਾਤਰਾ ਔਖੀ ਹੈ ਅਤੇ ਬਹੁਤ ਲੰਬੇ ਲੰਬੇ ਪਹਾੜ ਹਨ ਪਹਾੜੀਆਂ ਚੜ੍ਹਨੀਆਂ ਬਹੁਤ ਮੁਸ਼ਕਲ ਹਨ ਪਹਾੜੀਆਂ ਚੜ੍ਹਦੇ ਚੜ੍ਹਦੇ ਸਾਹ ਫੁੱਲਦੇ ਹਨ ਅਤੇ ਪਹਾੜੀਆਂ ਚੜ੍ਹਦੇ ਚੜ੍ਹਦੇ ਸਾਹ ਫੁੱਲ ਜਾਂਦੇ ਹਨ